ਓ ਬਈ ਸ਼ਰਟ ਮੈਂ ਤੁਹਾਡੇ ਤੋਂ ਮੰਗਵਾਈ ਕਿਹੋ ਜਿਹੀ ਸ਼ਰਟ ਭੇਜੀ ਕਿਹੜਾ ਸਾਈਜ਼ ਦੱਸਿਆ ਕਿਹੜਾ ਭੇਜ ਦਿੱਤਾ ਔਰ ਬਿਲਕੁਲ ਮੇਰੇ ਨਾਪ ਤਾਂ ਕਿਆ ਉਹ ਮੈਨੂੰ ਤਾਂ ਕਹਾਣੀ ਯਾਦ ਆ ਗਈ ਕਿ ਦਾਦਾ ਖਰੀਦੇ ਪੋਤਾ ਵਰਤੇ ਉਹ ਜਾਂ ਤਾਂ ਇਹ ਸ਼ਰਟ ਦਾ ਨਾਪ ਮੇਰੇ ਪੋਤੇ ਦੇ ਛੋਟੇ ਪੰਜ ਸਾਲ ਦੇ ਬੱਚੇ ਵਾਲਾ ਹੈ ਔਰ ਮੈਂ ਇਹਨੂੰ ਕਿੱਥੇ ਤੋਂ ਪਾਉਣਾ ਹੈ ਇਹਨੂੰ ਅੱਗੇ ਤੋਂ ਤੇਰੀ ਕੰਪਨੀ ਤੋਂ ਕੋਈ ਵੀ ਸ਼ਰਟ ਨਹੀਂ ਮੰਗਵਾਈ ਜਾਉਗੀ